ਹੈਲੋ ਹਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਹਾਂਜੀ ਦੱਸੋ ਕੰਮ ਹਾਂਜੀ ਅੱਛਾ ਹਾਂਜੀ ਹੈਗੇ ਨੇ ਨਵਾਂ ਸ਼ਹਿਰ ਗੁਰਦੁਆਰੇ ਬਾਬਾ ਦੀਪ ਸਿੰਘ ਦਾ ਏ ਰਾਜਾ ਸਾਹਿਬ ਇੱਥੇ ਸਾਡੇ ਪਿੰਡ ਵੀ ਹੈਗਾ ਇੱਕ ਗੁਰਦੁਆਰਾ ਹਾਂਜੀ ਤੁਸੀਂ ਕਿਹੜੇ ਗੁਰਦੁਆਰੇ ਘੁੰਮਣਾ ਏ ਹਾਂਜੀ ਹਾਂਜੀ ਅਸੀਂ ਜਾਂਦੇ ਹਾਂ ਹਰੇਕ ਐਤਵਾਰ ਰਾਜਾ ਸਾਹਿਬ ਮੱਥਾ ਟੇਕਣ ਅੱਛਾ ਤੁਹਾਡੇ ਨਾਲ ਕੌਣ ਕੌਣ ਹੈ ਹਾਂਜੀ ਫਿਰ ਕਿੰਨੀ ਤਰੀਕ ਨੂੰ ਜਾਣਾ ਹਾਂਜੀ ਇੱਕ ਤਰੀਕ ਨੂੰ ਦਸ ਵਜੇ ਤੱਕ ਚੱਲਾਂਗੇ ਮੈਨੂੰ ਦੱਸ ਦਿਓ ਫਿਰ ਟਾਈਮ ਹਾਂਜੀ ਮੇਰੇ ਕੋਲ ਟਾਈਮ ਹੈਗਾ ਐਤਵਾਰ ਦਾ ਚੱਲਾਂਗੇ ਫਿਰ ਹਾਂਜੀ ਸਾਡੇ ਪਿੰਡ ਵੀ ਹੈ ਨਹੀਂ ਨਹੀਂ ਮਿਲ ਜਾਣੇ ਉੱਥੇ ਰਸਤੇ 'ਚ ਲੈ ਲਿਓ ਹਾਂਜੀ ਸਾਡੇ ਪਿੰਡ ਵੀ ਹੈਗਾ ਇੱਕ ਗੁਰਦੁਆਰਾ ਨਾਲ ਏ ਤੁਹਾਨੂੰ ਉੱਥੇ ਘੁੰਮਾ ਲਵਾਂਗੇ ਹਾਂਜੀ ਹਾਂਜੀ ਮੈਨੂੰ ਘਰੋਂ ਤੁਰਨ ਲੱਗੇ ਇੱਕ ਵਾਰੀ ਕੋਲ ਕਰ ਦਿਓ ਫਿਰ ਹਾਂਜੀ ਓਕੇ ਧੰਨਵਾਦ